ਰੋਪੜ ਮਛੇਰਿਆਂ ਤੋਂ ਪਤਾ ਲੱਗਿਆ ਰਣਵੈਕਸੀ ਫੈਕਟਰੀ ਦਾ ਗੰਦਾ ਪਾਣੀ ਕੈਮੀਕਲ ਵਾਲਾ ਸਾਰਾ ਨਹਿਰ ਦੇ ਵਿੱਚ ਆ ਰਿਹਾ ਅਤੇ ਇਹ ਕੈਮੀਕਲ ਵਾਲਾ ਪਾਣੀ ਤਾਂ ਕਾਫੀ ਜ਼ਿਆਦਾ ਖਰਾਬ ਕਰ ਰਿਹਾ ਅਤੇ ਜਿੱਥੋਂ ਇਹ ਕੈਮੀਕਲ ਵਾਲਾ ਪਾਣੀ ਜਾ ਰਿਹਾ ਤਾਂ ਉੱਥੇ ਖਣ ਖੜ੍ਹ ਵੀ ਨਹੀਂ ਹੁੰਦਾ ਹੈਗਾ ਐਨਾ ਜ਼ਿਆਦਾ ਜ਼ਹਿਰੀਲਾ ਪਾਣੀ ਆ ਇਹੀ ਪਾਣੀ ਨਾਲ ਲੋਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹੈ ਤਾਂ ਇਹੀ ਪਾਣੀ ਸਾਡੇ ਫਸਲਾਂ ਨੂੰ ਖਰਾਬ ਕਰ ਰਿਹਾ ਅਤੇ ਫਸਲਾਂ 'ਚ ਕੋਈ ਵਾਧਾ ਨਹੀਂ ਕਰ ਰਿਹਾ ਅਤੇ ਅੱਗੇ ਤੋਂ ਅੱਗੇ ਸਾਡੇ ਸਰੀਰ ਨੂੰ ਬਿਮਾਰੀਆਂ ਲੱਗ ਰਹੀਆਂ ਬਿਮਾਰੀਆਂ ਵੀ ਇਹੋ ਜਿਹੇ ਤਰੀਕੇ ਨਾਲ ਕਾਫੀ ਜ਼ਿਆਦਾ ਗੰਦੀਆਂ ਬਿਮਾਰੀਆਂ ਲੱਗ ਰਹੀਆਂ ਜਿਸ ਦਾ ਕੋਈ ਇਲਾਜ ਜਲਦੀ ਤੋਂ ਜਲਦੀ ਵੀ ਨਹੀਂ ਹੋ ਰਿਹਾ ਅਤੇ ਕਾਫੀ ਜ਼ਿਆਦਾ ਪ੍ਰੋਬਲਮ ਦਾ ਇੱਕ ਹੈ ਅਤੇ ਇਹਨੂੰ ਕੈਮੀਕਲ ਵਾਲੇ ਪਾਣੀ ਨਾਲ ਕਾਫੀ ਜ਼ਿਆਦਾ ਸਾਡਾ ਨੁਕਸਾਨ ਹੋ ਰਿਹਾ ਅਤੇ ਇਸ ਨੂੰ ਕੈਮੀਕਲ ਵਾਲੇ ਪਾਣੀ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ